ਹੈਲੋ ਹਾਂਜੀ ਮਨਪ੍ਰੀਤ ਸਿੰਘ ਗੱਲ ਕਰ ਰਹੇ ਹੈ ਮੈਂ ਵਿਕਰਮ ਸਿੰਘ ਬੋਲ ਰਿਹਾ ਕੈਬ ਬੁੱਕ ਕਰਾਈ ਹੋਈ ਸੀਗੀ ਮੇਰੀ ਅਤੇ ਹੁਣ ਇੱਕ ਘੰਟਾ ਲੇਟ ਹੋ ਗਿਆ ਅਸੀਂ ਮੈਰਿਜ ਪਾਰਟੀ 'ਤੇ ਜਾਣਾ ਸੀਗਾ ਉਥੋਂ ਸਾਰੇ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਨੇ ਇੱਧਰ ਮੇਰਾ ਪਰਿਵਾਰ ਵੀ ਤਿਆਰ ਖੜ੍ਹਾ ਜੇ ਆਉਣਾ ਤਾਂ ਤੁਸੀਂ ਇਹ ਕੋਈ ਤਰੀਕਾ ਨਹੀਂ ਤਾਂ ਬੰਦਾ ਕਿਸੇ ਹੋਰ ਸਾਧਨ ਨਾਲ ਚਲੇ ਜਾਂਦਾ ਵਾਰ ਵਾਰ ਫੋਨ ਆਉਣ ਦੇ ਨਾਲ ਮੈਂ ਪਰੇਸ਼ਾਨ ਹੈ ਜੇ ਆਉਣਾ ਤਾਂ ਤੁਸੀਂ ਦੱਸੋ ਨਹੀਂ ਆ ਸਕਦੇ ਤਾਂ ਤੁਸੀਂ ਕੈਬ ਨਾ ਬੁੱਕ ਕਰਿਆ ਕਰੋ ਮੇਰਾ ਇੰਨਾ ਨੁਕਸਾਨ ਕਰਾ ਦਿੱਤਾ ਤੁਸੀਂ ਮੇਰੇ ਪੈਸੇ ਰਿਫੰਡ ਕਰੋ ਨਹੀਂ ਤਾਂ ਇੰਨੇ ਮੈਂ ਐਡਵਾਂਸ ਪੈਸੇ ਦਿੱਤੇ ਹੋਏ ਨੇ ਤੁਹਾਨੂੰ ਵੀ ਟਾਈਮ ਸਿਰ ਆ ਕੇ ਮੈਂ ਖੱਜਲ ਖਵਾਰ ਨਾ ਹੋਵਾਂ ਪੂਰਾ ਇੱਕ ਘੰਟਾ ਲੇਟ ਹੋ ਗਏ ਦਸ ਵਜੇ ਬੁਲਾਇਆ ਸੀਗਾ ਹੁਣ ਗਿਆਰ੍ਹਾਂ ਵੱਜ ਗਏ ਨੇ ਮੈਂ ਪਰਿਵਾਰ ਸਣੇ ਉਰੇ ਵੇਟ ਕਰ ਰਿਹਾ ਤੁਹਾਡੀ ਸਾਰਾ ਪਰਿਵਾਰ ਤਿਆਰ ਖੜ੍ਹਾ ਹੈ ਦੱਸੋ ਅੱਗੇ ਅਸੀਂ ਹੁਣ ਜਾਣ ਨੂੰ ਕਿਵੇਂ ਜਾਈਏ